ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਡਾਂ ਖੇਡਣ ਵਿੱਚ ਕਾਫੀ ਅੰਤਰ ਹੈ ਸ਼ਹਿਰੀ ਖੇਤਰਾਂ ਵਿੱਚ ਖੇਡਾਂ ਖੇਡਣ ਲਈ ਕਾਫੀ ਸੁਵਿਧਾਵਾਂ ਹਨ ਸ਼ਹਿਰਾਂ ਵਿੱਚ ਖੇਡਾਂ ਖੇਡਣ ਲਈ ਬਹੁਤ ਵਧੀਆ ਵਧੀਆ ਸਟੇਡੀਅਮ ਬਣੇ ਹੋਏ ਹਨ ਜਿੱਥੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਮਿਲਦੀ ਹੈ ਜੇਕਰ ਖੇਡਾਂ ਦੌਰਾਨ ਕੋਈ ਦੁਰਘਟਨਾ ਹੋ ਜਾਵੇ ਕਿਸੇ ਖਿਡਾਰੀ ਨਾਲ ਅਤੇ ਉਹਨਾਂ ਦੇ ਇਲਾਜ ਲਈ ਦੀ ਸੁਵਿਧਾ ਵੀ ਮੌਜੂਦ ਹਨ ਪਰ ਪੇਂਡੂ ਖੇਤਰਾਂ ਵਿੱਚ ਖਿਡਾਰੀਆਂ ਕੋਲ ਖੇਡਣ ਲਈ ਸਮਾਨ ਦੀ ਵੀ ਕਮੀ ਹੁੰਦੀ ਹੈ ਖੇਡਾਂ ਖੇਡਣ ਲਈ ਕੋਈ ਖਾਸ ਸਟੇਡੀਅਮ ਨਹੀਂ ਹੁੰਦੇ ਉੱਥੇ ਇਲਾਜ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਹੁੰਦਾ ਖਿਡਾਰੀਆਂ ਲਈ